ਹੈਲੋ ਹਾਂਜੀ ਜੋਗਾ ਫਿਟਨੈੱਸ ਕਲੱਬ ਤੋਂ ਬੋਲ ਰਹੇ ਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਇੱਕ ਨਾ ਇਨਕੁਆਇਰੀ ਲੈਣੀ ਸੀ ਤੁਹਾਡੇ ਤੋਂ ਜੀ ਤੁਸੀਂ ਯੋਗਾ ਇੰਸਟਰਕਟਰ ਹੀ ਹੋ ਅੱਛਾ ਜੀ ਤੇ ਮੈਨੂੰ ਇੱਕ ਕਲਾਸ ਚਾਹੀਦੀ ਯੋਗਾ ਲਈ ਜੀ ਨਹੀਂ ਨਹੀਂ ਮੈਂ ਸਿੰਗਲ ਹੀ ਆਂ ਜੀ ਹਾਂਜੀ ਹਾਂਜੀ ਤੇਰੀ ਏਜ ਟਵੈਂਟੀ ਫੋਰ ਆ ਹਾਂਜੀ ਹਾਂਜੀ ਮੇਰੀ ਏਜ ਟਵੈਂਟੀ ਫੋਰ ਆ ਜੀ ਮੈਨੂੰ ਨੀ ਨੀ ਵੈਸੇ ਫਿਜੀਕਲ ਫਿਟ ਲਈ ਰਹਿਣਾ ਚਾਹੁੰਦਾ ਜੀ ਮੈਂ ਹਾਂਜੀ ਹਾਂਜੀ

ਤੇ ਇਹਨਾਂ ਦੀ ਕੀ ਟਾਈਪਿੰਗ ਟਾਈਮਿੰਗ ਵਗੈਰਾ

ਆੱਛਾ ਉਨਦੇ ਵਿੱਚ ਅੱਛਾ ਜੀ ਨੀ ਮੈਨੂੰ ਤਾਂ ਟਾਈਮਿੰਗ ਏਹ ਮੈਂ ਫਿਰ ਸਟਡੀ ਦੀ ਵੀ ਮੈਂ ਕਾਲਜ ਜਿਵੇਂ ਜੁਆਇੰਨ ਕੀਤਾ ਮੈਂ ਜਾਣਾ ਹੁੰਦਾ ਮੈਨੂੰ ਟਾਈਮਿੰਗ ਫਿਰ ਉਹ ਦਿਓ ਜਿਵੇਂ ਕਿ ਸਵੇਰੇ ਪੰਜ ਤੋਂ ਜਿਵੇਂ ਹੋਜੇ ਅੱਛਾ ਨਹੀਂ ਮੈਨੂੰ ਫਿਰ ਸੁਬੇ ਵਾਲਾ ਹੀ ਕਰਾ ਦੋ ਨਾ ਹਾਂਜੀ ਤੇ ਉਹ ਫਿਰ ਉਹਨੇ ਕੀ ਫੀਸ ਵਗੈਰਾ ਜੀ ਤੇ ਪੱਚੀ ਸੋ ਰੁਪਏ ਮਹੀਨਾ ਮੰਥਲੀ ਇਕ ਮਹੀਨੇ ਦਾ ਦੋ ਹਜਾਰ ਪੰਜ ਸੋ ਰੁਪਇਆ ਲੈਸ ਹੋਜੂਗਾ ਅੱਛਾ ਜੇ ਕੱਠੀ ਦਿੰਨੇ ਓ ਜੀ ਤੇ ਫਿਰ ਫਾਇਦਾ ਤਾ ਫਿਰ ਇਕੱਠੀ 'ਚ ਹੀ ਹੈ ਜੀ ਅੱਛ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਐ ਚਲੋ ਫਿਰ ਤੁਸੀਂ ਨਾ ਮੇਰਾ ਇਹ ਵਾਲਾ ਦੂਸਰਾ ਫਿਰ ਕਰੋ ਮੇਰਾ ਵੀ ਫੋਮ ਫਿਲ ਜੋ ਵੀ ਹੈਗਾ ਕਰਨਾ ਤੁਸੀਂ ਇਕੱਠਾ ਮੈਨੂੰ ਈਅਰ ਲਈ ਕਰੋ ਹਾਂਜੀ ਮੇਰਾ ਨਾਮ ਨਵਦੀਪ ਰਾਏ ਐ ਅੱਛਾ ਲਾਭ ਕਰਨੀ ਪੈਣੀ ਐ ਜੀ ਚਲੋ ਠੀਕ ਹ ਜੀ ਮੈਂ ਥੋਨੂੰ ਸੈਂਡ ਕਰਦਾਂਗਾ ਚਲੋ ਮੈਂ ਕਰ ਦਿੰਨਾ ਜੀ ਆਪ ਓਕੇ ਓਕੇ